ਆਧੁਨਿਕਤਾ ਦੇ ਚੱਕਰ ਵਿੱਚ ਚਾਹੇ ਅੱਜ ਕੱਲ ਸਾਡਾ ਪਹਿਰਾਵਾ ਵਗੈਰਾ ਬਦਲ ਗਿਆ ਹੋਇਆ ਜਿਮ ਕੰਮ 'ਤੇ ਸਾਨੂੰ ਈਜ਼ੀ ਕੱਪੜੇ ਚਾਹੀਦੇ ਹੁੰਦੇ ਆ ਪਰ ਫ਼ਿਰ ਵੀ ਮੈਂ ਦੇਖਿਆ ਹੈ ਕਿ ਨੋਟ ਕੀਤਾ ਆ ਵੀ ਜਿਵੇਂ ਕੋਈ ਘਰ 'ਚ ਫੰਕਸ਼ਨਸ ਨੇ ਜਾਂ ਸਾਡੇ ਕੁਝ ਵੀ ਸੁੱਖ ਦੀ ਖੁਸ਼ੀ ਦੇ ਟਾਈਮ ਦੇ ਵਿੱਚ ਅਸੀਂ ਲੋਕ ਆਪਣੇ ਹੀ ਉਹਨਾਂ ਸੱਭਿਆਚਾਰ ਨੂੰ ਜਾਂ ਆਪਣੀ ਹੀ ਬਰਕਰਾਰ ਰੱਖਦੇ ਹਾਂ ਉਹੀ ਆਪਣੇ ਪਰੰਪਰਾ ਵਾਲੇ ਕੱਪੜੇ ਹੀ ਪਾਉਂਦੇ ਹਾਂ ਅਤੇ ਮੈਂ ਤਾਂ ਨੋਟ ਕੀਤਾ ਕਿ ਅੱਜ ਕੱਲ ਜਿਹੜਾ ਪਹਿਲੇ ਵਾਲੇ ਰਿਵਾਜ਼ ਆ ਜਿਹੜੇ ਪੁਰਾਣੀ ਪੰਜਾਬ ਵਾਲੇ ਰਿਵਾਜ਼ ਸੀਗੇ ਉਹਨਾਂ ਪਹਿਰਾਵਿਆਂ ਨੂੰ ਜਾਂ ਉਹਨਾਂ ਈਵਨ ਜਿਹੜੇ ਲੋਕ ਗੀਤਾਂ ਨੂੰ ਜਾਂ ਸਾਡੇ ਡਾਂਸ ਹੈਗਾ ਏ ਗਿੱਧਾ ਆ ਜਾਂ ਭੰਗੜਾ ਆ ਇਹਨੂੰ ਬੜੀ ਮਤਲਬ ਖੁਸ਼ੀ ਖੁਸ਼ੀ ਪਰਫੋਰਮ ਕੀਤਾ ਜਾਂਦਾ ਆ ਅਤੇ ਵੱਧ ਤੋਂ ਵੱਧ ਜਾਨੀ ਕਿ ਇਹੀ ਕਲਚਰ ਨੂੰ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਡਾ ਉਹ ਪੁਰਾਣਾ ਵਿਰਸਾ ਜਿਹੜਾ ਉਹ ਸੰਭਲਿਆ ਰਹੇ ਇਸ ਤੋਂ ਇਲਾਵਾ ਜਿਵੇਂ ਕੱਚੇ ਘਰਾਂ ਦਾ ਰਿਵਾਜ਼ ਸੀਗਾ ਅਤੇ ਕਈ ਥਾਵਾਂ 'ਤੇ ਨਾ ਉਹਨੂੰ ਸਿਰਫ ਦਰਸ਼ਨੀ ਬਣਾਉਣ ਲਈ ਮਤਲਬ ਬਣਾ ਦਿੱਤੇ ਗਏ ਹੈ ਵੀ ਕਿਵੇਂ ਦੇ ਘਰਾਂ 'ਚ ਅਸੀਂ ਰਹਿੰਦੇ ਸੀਗੇ ਆ ਹਾਲਾਂਕਿ ਆ ਹੁਣ ਤਾਂ ਪੱਕੇ ਘਰ ਹੈ ਪਰ ਸਿਰਫ ਦੇਖਣ ਲਈ ਸਾਡੇ ਉਹ ਉਹਨਾਂ ਜਗ੍ਹਾਂ ਦੇ ਵਿੱਚ ਜਿਵੇਂ ਸਾਡੇ ਚਰਖੇ ਵਗੈਰਾ ਜਾਂ ਤੱਕਲੇ ਜੋ ਵੀ ਆ ਜੋ ਚੀਜ਼ਾਂ ਸਾਡੇ ਬਜ਼ੁਰਗ ਵਰਤਦੇ ਰਹੇ ਖੇਤੀਬਾੜੀ ਦੇ ਸੰਦ ਉਹਨਾਂ ਨੂੰ ਮਤਲਬ ਬੜਾ ਇਕੱਠੇ ਕਰਕੇ ਰੱਖਿਆ ਹੋਇਆ ਤਾਂ ਕਿ ਸਾਡੇ ਬੱਚਿਆਂ ਨੂੰ ਜਾਣਕਾਰੀ ਮਿਲਦੀ ਰਹੇ ਕਿ ਸਾਡਾ ਜਿਵੇਂ ਸੱਭਿਆਚਾਰ ਸੀਗਾ ਜਾਂ ਸਾਡਾ ਵਿਰਸਾ ਕੀ ਸੀਗਾ ਅਤੇ ਉਹਦੇ ਜਾਣਕਾਰੀ ਨੂੰ ਬਣੀ ਰਹੇ